ਹੈਲੋ ਜੀ ਸਰ ਮੈਂ ਆਪਦੇ ਘਰ ਦੇ ਅੰਦਰ ਨਾ ਕਰਵਾਉਣੀ ਸੀ ਅਤੇ ਮੈਂ ਪੁੱਛ ਰਿਹਾ ਸੀ ਤੁਸੀਂ ਕੰਪਨੀ ਤੋਂ ਹੀ ਬੋਲ ਰਹੇ ਹੋ ਇਲੈਕਟ੍ਰੀਸਿਟੀ ਵਾਲੀ ਕੰਪਨੀ ਤੁਹਾਡੀ ਕਿਹੜੀ ਹੈਗੀ ਠੀਕ ਹੈ ਅਤੇ ਸਰ ਅਸੀਂ ਆਪਦੇ ਘਰ ਦੇ ਅੰਦਰ ਲਾਈਟਿੰਗ ਕਰਵਾਉਣੀ ਸੀ ਪ੍ਰੋਪਰ ਜਿਹੜੀ ਆਉਂਦੀ ਹੈ ਨਾ ਬਲਬਸ ਵਗੈਰਾ ਅੱਛੀ ਕੁਆਲਟੀ ਦੇ ਐੱਲ ਈ ਡੀਸ ਜਿਹੜੇ ਲੇਟੈਸਟ ਚੱਲ ਰਹੇ ਨੇ ਅਤੇ ਸਮੋਲ ਜਿਹੜੀ ਸਟਰਿੱਪਸ ਵਾਲੀ ਟਿਊਬਸ ਹੁੰਦੀਆਂ ਨੇ ਇਸ ਬਾਰੇ ਮੈਂ ਤੁਹਾਡੇ ਤੋਂ ਪੁੱਛਣਾ ਦੱਸ ਸਕਦੇ ਹੋ ਕੀ ਹੈ ਕੀ ਤੁਹਾਡੇ ਕੋਲ ਅਵੇਲੇਬਲ ਹੈ ਹਾਂਜੀ ਪੂਰੇ ਕਰ ਦੇਣ ਤਾਂ ਕਰਵਾਉਣੀ ਹੈ ਅਸੀਂ ਨਵਾਂ ਘਰ ਬਣਾ ਰਹੇ ਹਾਂ ਸਰ ਪਾਈਪਿੰਗ ਪਾਈਪਿੰਗ ਤਾਂ ਹੋ ਗਈ ਹੈ ਪਰ ਵਾਇਰਿੰਗ ਸ਼ਾਇਦ ਨਹੀਂ ਹੋਈ ਹੁਣ ਇਹ ਵਾਇਰਿੰਗ ਤੁਸੀਂ ਦੇਖ ਲਏ ਜੇ ਤੁਹਾਡੀ ਕੰਪਨੀ ਕਰਦੀ ਹੋਵੇਗੀ ਦੋਵੇਂ ਹੀ ਹਾਂਜੀ ਹਾਂਜੀ ਹਾਂਜੀ ਵਾਇਰਿੰਗ ਦਾ ਤਾਂ ਹ ਹਾਂਜੀ ਉਹ ਵੀ ਕਰਨਾ ਅਤੇ ਲਾਈਟਿੰਗ ਦਾ ਮੇਨ ਮੈਂ ਪੁੱਛਣਾ ਸੀ ਵੀ ਲਾਈਟਿੰਗ ਕਿਹੜੀ ਕਿਹੜੀ ਤੁਸੀਂ ਪ੍ਰੋਵਾਈਡ ਕਰਦੇ ਹੋ ਹਾਂਜੀ ਹਾਂਜੀ ਮੈਂ ਵੇਖੇ ਨੇ ਅਲੱਗ ਅਲੱਗ ਕਲਰ ਚੇਂਜ ਕਰਦੇ ਨੇ

ਠੀਕ ਹੈ ਸਰ ਇੱਕ ਤਾਂ ਸਮਾ ਸਮਾਟ ਬਲੱਬਸ ਹੀ ਆਉਂਦੇ ਨੇ ਉਹ ਵੀ ਤੁਹਾਡੇ ਕੋਲ ਹੋਣਗੇ ਸਮਾਟ ਬਲੱਬਸ ਜਿਵੇਂ ਫੋਨ ਦੇ ਨਾਲ ਕੁਨੈਕਟ ਹੋ ਜਾਂਦੇ ਨੇ ਉਹਦੇ ਨਾਲ ਅਸੀਂ ਓਨ ਜਾਂ ਓਫ ਕਰ ਸਕਦੇ ਹਾਂ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਸਰ ਮੈਂ ਉਹ ਵੀ ਸੋਚ ਰਿਹਾ ਸੀ ਲਵਾਉਣ ਵਾਸਤੇ ਜਿਹੜਾ ਤੁਸੀਂ ਦੱਸਿਆ ਸੀਲਿੰਗ ਫੈਨ ਅੰਦਰ ਲੱਗ ਜਾਂਦਾ ਅਤੇ ਨੌਰਮਲ ਮੈਂ ਸਰ ਇਹ ਚਾਹੁੰਦਾ ਕਿ ਸਮਾਟ ਬੱਲਬਸ ਹੀ ਲੱਗਣ ਤਾਂ ਕਿ ਮੈਂ ਸਾਰਾ ਆਪਦੇ ਫੋਨ 'ਤੇ ਸਾਰਾ ਕੰਟਰੋਲ ਕਰ ਲਵਾਂਗਾ ਆਪਦੀ ਲਾਈਟਿੰਗ ਅਤੇ ਮੈਂ ਸੋਚ ਰਿਹਾ ਸੀ ਤੁਸੀਂ ਦੱਸ ਸਕਦੇ ਕਿ ਸੀ ਐਫ ਐੱਲ ਤਾਂ ਓਨੇ ਚੱਲਦੇ ਨੇ ਇਸ ਟਾਈਮ ਸੀ ਐਫ ਐਲ ਚੱਲ ਰਹੇ ਨੇ ਸਰ ਤੁਹਾਡੇ ਕੋਲ

ਠੀਕ ਹੈ ਪਰ ਮੈਂ ਸੋਚ ਰਿਹਾ ਸੀ ਐੱਲ ਈ ਡੀ ਵੀ ਲਵਾਵਾਂ ਮੈਂ ਬਸ ਸੋਚ ਰਿਹਾ ਸੀ ਸ਼ਾਇਦ ਆਊਟਡੇਟਡ ਹੋਣਗੇ ਉਹ ਹਾਂਜੀ ਸਰ ਵੇਖੋ ਹਾਂਜੀ ਬਜਟ ਸਰ ਇੱਕ ਵਾਰੀ ਤਾਂ ਮੈਂ ਫਿਫਟੀ ਥਾਉਜੈਂਟ ਲੈ ਕੇ ਚੱਲ ਰਿਹਾ ਹਾਉਸ ਵਾਇਰਿੰਗ ਦਾ ਖਰਚਾ ਜ਼ਿਆਦਾ ਆਉਂਦਾ ਲਾਈਟਿੰਗ ਅੱਜ ਕੱਲ੍ਹ ਕਾਫ਼ੀ ਮਹਿੰਗੀ ਹੋ ਗਈ ਹੈ ਹਾਂਜੀ ਠੀਕ ਐ ਸਰ ਠੀਕ ਹੈ ਸਰ ਉਹ ਤੁਸੀਂ ਵੇਖ ਲਈਓ ਉੱਤੇ ਥੱਲੇ ਕਿੰਨਾ ਬਣ ਰਿਹਾ ਬਾਕੀ ਮੈਂ ਬਸ ਆਹੀ ਪੁੱਛਣਾ ਸੀ ਡੇਟ ਡੇਟ ਦੱਸ ਦਿਉ ਤੁਸੀਂ ਡੇਟ ਦੱਸ ਦਿਉ ਕਦੋਂ ਤੁਸੀਂ ਆਓਗੇ ਠੀਕ ਹੈ ਠੀਕ ਹੈ ਸਰ ਠੀਕ ਹੈ ਸਰ ਠੀਕ ਹੈ ਸਰ ਤੁਸੀਂ ਭੇਜ ਦਿਉ ਜੇ ਅਤੇ ਮੈਨੂੰ ਕੌਲ ਕਰ ਲਿਓ ਜੇ ਆਉਣ ਤੋਂ ਪਹਿਲੇ